ਡੇਂਗੂ ਬੁਖਾਰ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਗਰਮੀਆਂ ਦੀਆਂ ਬਿਮਾਰੀਆ ਹਨ ਜੋ ਕੀ ਮੱਛਰਾਂ ਤੋਂ ਫੈਲਦੀਆਂ ਹਨ ਮੱਛਰ ਰੁਕੇ ਹੋਏ ਗੰਦੇ ਪਾਣੀ ਦੇ ਉੱਪਰ ਬੈਠਦਾ ਹੈ ਅਤੇ ਆਪਣਾ ਲਾਰਵਾ ਛੱਡਦਾ ਹੈ ਉਸ ਤੋਂ ਬਾਦ ਇਹ ਬਿਮਾਰੀਆਂ ਉਤਪਨ ਹੁੰਦੀਆਂ ਹਨ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਸਾਨੂੰ ਗਰਮੀਆਂ ਦੇ ਵਿੱਚ ਕੂਲਰਾਂ ਦੇ ਵਿੱਚ ਦੋ ਦਿਨ ਤੋਂ ਬਾਦ ਬਦਲਨਾ ਚਾਈਦਾ ਹੈ ਅਤੇ ਗਮਲਿਆਂ ਦੇ ਵਿੱਚ ਵੀ ਪਾਣੀ ਉੱਨੀ ਮਾਤਰਾ ਵਿੱਚ ਪਾਣਾ ਚਾਈਦਾ ਹੈ ਜਿੰਨਾ ਕੇ ਉਹ ਸੁੱਕ ਜਾਵੇ ਅਤੇ ਛੱਤ ਦੇ ਉੱਪਰ ਟੁੱਟੀਆਂ ਹੋਈਆਂ ਚੀਜ਼ਾਂ ਜਾਂ ਕਬਾੜ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਘਰ ਦੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਚਾਈਦੀ ਹੈ ਅਤੇ ਨਾਲ਼ੀਆਂ ਦਾ ਪਾਣੀ ਵੀ ਖੜ੍ਹਾ ਨਹੀਂ ਹੋਣ ਦੇਣਾ ਅਤੇ ਅਤੇ ਸਾਫ਼ ਪਾਣੀ ਰੱਖਣਾ ਚਾਈਦਾ ਹੈ ਪਿੰਡਾਂ ਵਿੱਚ ਛੱਪੜਾਂ ਵਿੱਚ ਕੀਟਨਾਸ਼ਕ ਦੁਆਈ ਪਾਣੀ ਚਾਈਦੀ ਹੈ ਅਤੇ ਆਪਣੇ ਘਰਾਂ ਵਿੱਚ ਵੀ ਮੋਟ ਮੋਸਕੀਟੋ ਕੁਆਇਲਸ ਲਗਾਣੀਆਂ ਚਾਈਦੀਆਂ ਹਨ ਬਾਹਰ ਨਿਲਕਨ ਸਮੇਂ ਬੱਚਿਆਂ ਨੂੰ ਓਡੋਮੋਸ ਕਰੀਮ ਲਗਾਣੀ ਚਾਈਦੀ ਹੈ ਅਤੇ ਸੋਂਦੇ ਸਮੇਂ ਬੱਚਿਆਂ ਨੂੰ ਮੱਛਰਦਾਨੀ ਦਾ ਇਸਤੇਮਾਲ ਕਰਨਾ ਚਾਈਦਾ ਹੈ ਅਤੇ ਡੀ ਡੀ ਟੀ ਦਾ ਸਪਰੇਅ ਵੀ ਘਰ ਦੇ ਵਿੱਚ ਕਰਨਾ ਚਾਈਦਾ ਹੈ ਅਤੇ ਕਾਰਪੋਰੇਸ਼ਨ ਨੂੰ ਰਿਕੁਐਸਟ ਕਰਨੀ ਚਾਈਦੀ ਹੈ ਕੀ ਉਹ ਮੁਹੱਲੇ ਅਤੇ ਗਲੀਆਂ ਵਿੱਚ ਧੂੰਏ ਵਾਲੀ ਗੱਡੀਆਂ ਦਾ ਇਸਤੇਮਾਲ ਕਰਕੇ ਧੂੰਏ ਦਾ ਛਿੜਕਾਵ ਕਰਨ ਤਾਂ ਜੋ ਮੱਛਰ ਮਾਰਿਆ ਜਾ ਸਕੇ ਅਤੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ